ਮੈਂ ਪੰਜਾਬ ਦੇ ਮਾਝੇ ਦਾ ਰਹਿਣ ਵਾਲਾ ਹਾਂ ਇੱਥੇ ਦੀ ਬੋਲੀ ਅਤੇ ਮੇਰੇ ਨਾਨਕੇ ਜੋ ਕਿ ਦੁਆਬਾ ਦੇ ਵੱਲ ਹੈ ਉਹਨਾਂ ਦੀ ਬੋਲੀ ਦੇ ਵਿੱਚ ਬਹੁਤ ਹੀ ਫ਼ਰਕ ਹੈ ਮੈਂ ਕਈ ਵਾਰੀ ਉੱਥੇ ਜਾਂਦਾ ਹਾਂ ਤਾਂ ਉੱਥੋਂ ਦੇ ਲੋਕ ਮੈਨੂੰ ਈ ਕਹਿੰਦੇ ਹਨ ਕਿ ਤੁਸੀਂ ਮਾਝੇ ਵਾਲੇ ਜਾਂ ਅੰਮ੍ਰਿਤਸਰ ਵਾਲੇ ਡਿਆ ਏਂ ਡਿਆ ਏਂ ਹਰ ਗੱਲ ਦੇ ਪਿੱਛੇ ਜ਼ਰੂਰ ਲਾਉਂਦੇ ਹੋ ਮੈਂ ਉੱਥੇ ਜਾ ਕੇ ਦੇਖਦਾ ਹਾਂ ਉੱਥੋਂ ਦੀ ਬੋਲੀ ਹੋਰ ਤਰ੍ਹਾਂ ਦੀ ਬੋਲੀ ਜਾਂਦੀ ਹੈ ਅਤੇ ਜੋ ਕਿ ਅੰਮ੍ਰਿਤਸਰ ਮਾਝੇ ਵੱਲ ਕੋਈ ਹੋਰ ਹੀ ਬੋਲੀ ਹੈ ਇਹ ਖੇਤਰੀ ਭਾਸ਼ਾ ਵੱਖਰੀ ਵੱਖਰੀ ਹੋਣ ਹੈਗੀ ਹੈ ਮੈਂ ਪੰਜਾਬ ਦੀਆਂ ਬੋਲੀਆਂ ਬਾਰੇ ਦੱਸਣਾ ਚਾਹੁੰਦਾ ਹਾਂ ਜਿਨ੍ਹਾਂ ਦੇ ਵਿੱਚ ਟੱਪੇ ਭੰਗੜਾ ਬਹੁਤ ਹੀ ਪ੍ਰਸਿੱਧ ਹੈ ਇੱਥੋਂ ਦੀਆਂ ਬੋਲੀਆਂ ਬੜੀ ਖੁਸ਼ੀ ਦੇ ਮੌਕੇ ਦੇ ਵਿੱਚ ਬੋਲੀਆਂ ਜਾਂਦੀਆਂ ਹਨ ਇੱਥੋਂ ਦੀ ਬੋਲੀ ਦੇ ਉੱਤੇ ਬਹੁਤ ਸਾਰੀਆਂ ਫਿਲਮਾਂ ਆਦਿ ਵੀ ਬਣ ਚੁੱਕੀਆਂ ਹਨ ਇੱਥੋਂ ਦੀ ਬੋਲੀ ਕਨੇਡਾ ਦੇ ਵਿੱਚ ਵੀ ਬਹੁਤ ਬੋਲੀ ਜਾਂਦੀ ਹੈ